ਜਿਹੜੇ ਵੀ ਮੈਂ ਆਪਣੇ ਬਾਗ ਦੇ ਵਿੱਚ ਪੌਦੇ ਅਤੇ ਰੁੱਖ ਲਗਾਏ ਹਨ ਜਦੋਂ ਉਹਨਾਂ ਨੂੰ ਮੈਂ ਖਿੜਦੇ ਦੇਖਦੀ ਹਾਂ ਤਾਂ ਮੈਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਜਿਸ ਨਾਲ ਮੇਰੇ ਬਾਗ ਦੀ ਸੁੰਦਰਤਾ ਦਾ ਵੀ ਸੁੰਦਰਤਾ 'ਤੇ ਵੀ ਬਹੁਤ ਜ਼ਿਆਦਾ ਵਧੀਆ ਪ੍ਰਭਾਵ ਪੈਂਦਾ ਹੈ ਮੈਂ ਛੋਟੇ ਜਦੋਂ ਪੌਦੇ ਲਾਏ ਸੀ ਤਾਂ ਬਹੁਤ ਛੋਟੇ ਛੋਟੇ ਹੁੰਦੇ ਸੀ ਅਤੇ ਉਹਨਾਂ ਨੂੰ ਵੱਧਦੇ ਫੁੱਲਦੇ ਆਪਣੇ ਅੱਖੀਂ ਦੇਖਿਆ ਅਤੇ ਉਹਨਾਂ ਨੂੰ ਦੇਖਦੇ ਹੋਏ ਮੈਨੂੰ ਇਹ ਮਾਣ ਹੁੰਦਾ ਕਿ ਮੈਂ ਥੋੜ੍ਹਾ ਜਿਹਾ ਐਫਟ ਆਪਣੇ ਵਾ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਦੇ ਵਿੱਚ ਕਰ ਰਹੀ ਹਾਂ ਤਾਂ ਜੋ ਵਾਤਾਵਰਨ ਜੇਕਰ ਵਾਤਾਵਰਨ ਸਾਫ ਸੁਥਰਾ ਹੁੰਦਾ ਹੈ ਤਾਂ ਪੌਦਿਆਂ ਅਤੇ ਰੁੱਖ ਰੁੱਖਾਂ 'ਚ ਵੀ ਵਾਧਾ ਹੁੰਦਾ ਹੈ ਅਤੇ ਪ ਪੌਦਿਆਂ ਅਤੇ ਰੁੱਖਾਂ ਨੂੰ ਵੱਧਦਾ ਫੁੱਲਦਾ ਦੇਖ ਕੇ ਉਹਨਾਂ ਦਾ ਬਾਗ ਦੀ ਡੈਕੋਰੇਸ਼ਨ ਦਾ ਵੀ ਬਹੁਤ ਜ਼ਿਆਦਾ ਵਧੀਆ ਢੰਗ ਹੁੰਦਾ ਹੈ ਪੌਦੇ ਅਤੇ ਰੁੱਖ ਜਦੋਂ ਜਿਹੜੇ ਕਿ ਮੈਂ ਛੋਟੇ ਹੁੰਦੇ ਤੋਂ ਹੀ ਲਗਾਏ ਸੀ ਅਤੇ ਮੈਂ ਹੌਲੀ ਹੌਲੀ ਜਦੋਂ ਉਹਨਾਂ ਨੂੰ ਵੱਧਦੇ ਫੁੱਲਦੇ ਦੇਖਦੀ ਹਾਂ ਅਤੇ ਖਿੜਿਆ ਦੇਖਦੀ ਹਾਂ ਤਾਂ ਮੇਰੇ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਅਤੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਮੈਂ ਆਪਣੇ ਵਾਤਾਵਰਨ ਨੂੰ ਬਚਾਉਣ ਵਿੱਚ ਥੋੜ੍ਹਾ ਜਿਹਾ ਸਹਿਯੋਗ ਪਾ ਰਹੀ ਹਾਂ ਜੇਕਰ ਆਪਾਂ ਪੌਦੇ ਅਤੇ ਰੁੱਖ ਲਗਾਉਂਦੇ ਹਾਂ ਤਾਂ ਉਹਨਾਂ ਨਾਲ ਆਪਾਂ ਨੂੰ ਸੁੰਦਰਤਾ ਅਤੇ ਨਾਲ ਨਾਲ ਔਕਸੀਜਨ ਵੀ ਪ੍ਰਾਪਤ ਹੁੰਦੀ ਹੈ ਹੁੰਦੀ ਹੈ ਜਿਸ ਨਾਲ ਸਾਡਾ ਵਾਤਾਵਰਨ ਸੁੰਦਰਤਾ ਬਣਾਈ ਰੱਖਦੇ ਹਨ ਬਣਾਈ ਰੱਖਦੇ ਹਨ ਬਾਗ ਦੇ ਵਿੱਚ ਲਗਾਏ ਰੁੱਖ ਅਤੇ ਫੁੱਲ ਜਦੋਂ ਖਿੜਦੇ ਹਨ ਤਾਂ ਮਨ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਹੈ